ਖੇਡਾਂ ਨਾਲ ਸੰਬੰਧਿਤ ਅਸੀਂ ਬਹੁਤ ਸਾਰੀਆਂ ਖੇਡਾਂ ਖੇਡ ਸਕਦੇ ਹਾਂ ਜਿਵੇਂ ਕਿ ਕਬੱਡੀ ਕ੍ਰਿਕਟ ਖੋ ਖੋ ਮੈਚ ਸਾਨੂੰ ਇਹਨਾਂ ਦੀ ਖੇਡਣ ਵਾਸਤੇ ਗਰਾਊਂਡ ਵਿੱਚ ਜਾਣਾ ਚਾਹੀਦਾ ਹੈ ਅਤੇ ਆਪਣੇ ਉਸਤਾਦ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਬਹੁਤ ਬਹੁਤ ਚੰਗੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਖੇਡਾਂ ਨਾਲ ਆਪਣੇ ਸਰੀਰ ਦੀ ਤੰਦਰੁਸਤੀ ਆਉਂਦੀ ਹੈ ਦਿਮਾਗ ਤੇਜ਼ ਉਹ ਹੁੰਦਾ ਹੈ ਅਤੇ ਐਨਰਜੀ ਆਉਂਦੀ ਹੈ ਪੜ੍ਹਾਈ ਵਿੱਚ ਮਨ ਲੱਗਦਾ ਹੈ ਸਾਨੂੰ ਖੇਡਾਂ ਜ਼ਰੂਰੀ ਹਨ ਇਸ ਦੀ ਪ੍ਰਕਿਰਿਆ ਦਾ ਵੀ ਪਾਲਣ ਕਰਨਾ ਚਾਹੀਦਾ ਹੈ ਖੇਡਾਂ ਨਾਲ ਸਰੀਰ ਬਹੁਤ ਹੀ ਤੰਦਰੁਸਤ ਹੁੰਦਾ ਹੈ ਅਸੀਂ ਖੇਡਾਂ ਦੇ ਖੇਤਰ ਵਿੱਚ ਪ੍ਰਕਿਰਿਆ ਦਾ ਪਾਲਣ ਕਰ ਸਕਦੇ ਹਾਂ ਜਿਵੇਂ ਕਿ ਆਪਣੇ ਉਸਤਾਦ ਦੀ ਇੱਜ਼ਤ ਕਰਕੇ ਅਤੇ ਦੂਜਿਆਂ ਦਾ ਵੀ ਧਿਆਨ ਆਪਣੇ ਵੱਲ ਖਿੱਚ ਕੇ ਇਸ ਦੀ ਪਾਲਣਾ ਕਰ ਸਕਦੇ ਹਾਂ